ਮੇਰਾ ਨਾਮ ਦਿਲਪ੍ਰੀਤ ਸਿੰਘ ਹੈ ਅਤੇ ਮੈਂ ਐਮਾਜ਼ੋਨ 'ਤੇ ਇੱਕ ਔਡਰ ਕੀਤਾ ਸੀ ਮੈਂ ਐਮਜੋਨ ਤੋਂ ਮੋਬਾਈਲ ਦਾ ਚਾਰਜਰ ਔਡਰ ਕੀਤਾ ਸੀ ਮੈਂ ਇਹ ਚਾਰਜਰ ਦਸ ਮਾਰਚ ਨੂੰ ਔਡਰ ਕਰਿਆ ਸੀ ਐਮਜੋਨ ਤੋਂ ਅਤੇ ਇਹ ਕੱਲ੍ਹ ਔਡਰ ਆਇਆ ਮੇਰਾ ਅਤੇ ਜਿਹੜਾ ਡਿਲ ਡਿਲੀਵਰੀ ਬੋਆਏ ਸੀ ਜਿਹੜਾ ਡਿਲੀਵਰੀ ਦੇਣ ਆਇਆ ਸੀ ਮੇਰੇ ਔਡਰ ਦੀ ਉਹ ਉਹਨੇ ਮੇਰੇ ਨਾਮ ਚੰਗਾ ਵਿਵਹਾਰ ਨਹੀਂ ਕੀਤਾ ਜਦੋਂ ਉਹ ਡਿਲੀਵਰੀ ਲੈ ਕੇ ਆਇਆ ਤਾਂ ਉਹਨੇ ਮੈਨੂੰ ਫੋਨ ਕੀਤਾ ਪਹਿਲਾਂ ਤਾਂ ਫੋਨ 'ਤੇ ਮੇਰੇ ਨਾਲ ਗਲਤ ਬੋਲਿਆ ਉਹ ਮੈਨੂੰ ਚੰਗੀ ਤਰ੍ਹਾਂ ਢੰਗ ਨਾਲ ਪੇਸ਼ ਨਹੀਂ ਆਇਆ ਮੇਰੇ ਨਾਲ ਫਿਰ ਉਸ ਤੋਂ ਬਾਅਦ ਜਦੋਂ ਮੈਂ ਉਹਨੂੰ ਘਰ ਦਾ ਅਡਰੈਸ ਦ ਦੱਸਿਆ ਵੀ ਇਸ ਜਗ੍ਹਾ 'ਤੇ ਆ ਜਾਓ ਤਾਂ ਉੱਥੇ ਜਦੋਂ ਆਇਆ ਉਹ ਉੱਥੇ ਵੀ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕੀਤੀ ਉਹਨੂੰ ਗੱਲ ਕਰਨ ਦਾ ਢੰਗ ਨਹੀਂ ਸੀ ਬਿਲਕੁਲ ਵੀ ਮੈਂ ਪੇਮੈਂਟ ਕਰਨ ਲੱਗਿਆ ਤਾਂ ਮੇਰੇ ਬੈਂਕ ਸਰਵਰ ਡਾਊਨ ਹੋਣ ਕਰਕੇ ਪੇਮੈਂਟ ਥੋੜ੍ਹੀ ਲੇਟ ਹੋ ਗਈ ਇਸ ਕਰਕੇ ਉਹ ਫਿਰ ਮੇਰੇ ਨਾਲ ਲੜਨ ਲੱਗ ਗਿਆ ਅਤੇ ਮੈਨੂੰ ਗਾਲਾਂ ਕੱਢੀਆਂ ਉਸ ਨੇ ਉਸ ਦਾ ਢੰਗ ਬਹੁਤ ਅਸ਼ਲੀਲ ਸੀ ਅਤੇ ਅਣਉਚਿਤ ਢੰਗ ਨਾਲ ਵਿਵਹਾਰ ਕੀਤਾ ਉਹਨੇ ਮੇਰੇ ਨਾਲ ਇਸ ਕਰਕੇ ਮੈਂ ਉਸਦੀ ਕੰਪਲੇਂਟ ਪਾਉਣਾ ਚਾਹੁੰਦਾ ਹਾਂ ਉਸ ਨੇ ਮੇਰੇ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਅਤੇ ਜਦੋਂ ਮੈਂ ਉਸ ਨੂੰ ਕਿਹਾ ਕਿ ਮੈਂ ਉਸ ਦੀ ਕੰਪਲੇਂਟ ਕਰ ਦੇਵਾਂਗਾ ਤਾਂ ਫਿਰ ਉਸ ਨੇ ਮੈਨੂੰ ਧਮਕੀ ਦੇਣੀ ਸ਼ੁਰੂ ਕਰ ਦਿੱਤੀਆਂ ਤਾਂ ਕਰ ਕੇ ਮੈਂ ਉਸ ਦੀ ਕੰਪਲੇਂਟ ਕਰ ਰਿਹਾ ਹਾਂ ਕਿ ਉਹਨਾਂ ਨੂੰ ਅੱਗੇ ਵਾਸਤੇ ਸਮਝਾਇਆ ਜਾਵੇ ਤਾਂ ਕਿ ਉਹ ਕਿਸੇ ਹੋਰ ਨਾਲ ਅੱਗੇ ਤੋਂ ਇੱਦਾਂ ਦਾ ਅਣਉਚਿਤ ਢੰਗ ਨਾਲ ਵਿਵਹਾਰ ਨਾ ਕਰਨ ਮੈਨੂੰ ਉਸ ਨੇ ਫਿਰ ਧਮਕੀ ਵੀ ਦਿੱਤੀ ਕਿ ਜੇ ਤੁਸੀਂ ਕੰਪਲੇਂਟ ਕੀਤੀ ਤਾਂ ਮੈਂ ਤੁਹਾਨੂੰ ਤੰਗ ਕਰਾਂਗਾ ਛੇੜਾਂਗਾ ਤੁਹਾਨੂੰ ਅੱਗੇ ਵਾਸਤੇ ਫਿਰ ਤੰਗ ਕਰਾਂਗਾ ਮੈਨੂੰ ਉਸ ਉਹ ਡਰਾਉਣ ਲੱਗ ਪਿਆ ਸੋ ਕਿਰਪਾ ਕਰਕੇ ਮੇਰੀ ਗੱਲ ਸੁਣੀ ਜਾਵੇ ਅਤੇ ਉਸ ਨੂੰ ਜਾਂ ਤਾਂ ਕੰਮ ਤੋਂ ਕੱਢ ਦਿੱਤਾ ਜਾਵੇ ਜਾਂ ਫਿਰ ਅੱਗੇ ਲਈ ਸਮਝਾਇਆ ਜਾਵੇ ਅਤੇ ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਜੋ ਅੱਗੇ ਵਾਸਤੇ ਕਿ ਕਿਸੇ ਹੋਰ ਨਾਲ ਉਹ ਐਦਾਂ ਪੇਸ਼ ਨਾ ਆਵੇ